ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਭਾਅ ਜੀ ਵਧੀਆ ਵਧੀਆ ਭਾਅ ਜੀ ਤੁਸੀਂ ਸੁਣਾਓ ਅੱਛਾ ਅੱਛਾ ਹਾਂ ਆਪਣੇ ਰਮਨ ਭਾਅ ਜੀ ਠੀਕ ਆ ਠੀਕ ਆ ਪਛਾਣ ਲਿਆ ਦੱਸੋ ਭਾਅ ਜੀ ਕੀ ਸੇਵਾ ਕਰੀਏ ਅੱਛਾ ਜੀ ਭਾਅ ਜੀ ਮਤਲਬ ਸ਼ੂਜ਼ ਆਪਣੇ ਕੋਲ ਵਾਧੂ ਅਵੇਲੇਵਲ ਹੈਗੇ ਤੇ ਬਸ ਇਹੀ ਗੱਲ ਐ ਕੀ ਤੁਹਾਡਾ ਬਜਟ ਦੇ ਹਿਸਾਬ ਨਾਲ ਹੋਣਾ ਨਾ ਜੇ ਚਲੋ ਤੁਸੀਂ ਰਨਿੰਗ ਲਈ ਪਾਣੇ ਹਨਾ ਤੁਹਾਡਾ ਇਹ ਰਿਕੁਆਇਰਮੈਂਟ ਹੈਗੀ ਅੱਛਾ ਅੱਛਾ ਜੀ ਤੇ ਤੁਹਾਡੇ ਲਾਈਟ ਵੇਟ ਹਨਾ ਜੀ ਜਿੱਦਾਂ ਪੰਜ ਸੱਤ ਹਜ਼ਾਰ ਦੇ ਐ ਤਾਂ ਭਾਅ ਜੀ ਪੰਜ ਸੱਤ ਹਜਾਰ ਦੇ ਈ ਵਧੀਆ ਆ ਜਾਂਦੇ ਸ਼ੂਜ ਥੋੜਾ ਜਿਹਾ ਬਜਟ ਤੁਸੀਂ ਆਪਣਾ ਮਤਲਬ ਹਜਾਰ ਖੰਡ ਦੋ ਹਜਾਰ ਵਿੱਚ ਪਾਂਦੇ ਆ ਤਾਂ ਫਿਰ ਜਮਾਂ ਹੀ ਹੈਨਾ ਬਣੀ ਇਸ ਚੀਜ਼ ਲਈ ਉਹ ਚਾਜ ਹਾਂ ਰਨਿੰਗ ਲਈਏ ਬਣੀ ਆ ਜਿੱਦਾਂ ਭਾਅ ਜੀ ਆਪਣੇ ਕੋਲ ਪਿਉਮਾ ਵੀ ਅਵੇਲੇਬਲ ਹੈਗਾ ਪਿਉਮਾ ਤੇ ਇੱਕ ਨਾਈਟਰੋ ਮਾਡਲ ਆਇਆ ਨਵਾਂ ਹੀ ਉਹਦੇ ਵਿੱਚ ਕਲਰ ਵੀ ਸਾਰੇ ਮਿਲ ਜਾਣਗੇ ਤੁਹਾਨੂੰ ਤੇ ਕਾਫੀ ਲਾਈਟ ਵੇਟ ਹੈ ਤੇ ਅੱਜ ਕੱਲ ਅਥਲੀਟ ਬਹੁਤ ਯੂਜ ਕਰਦੇ ਭਾਅ ਜੀ ਮੋਸਟ ਸੈਲਿੰਗ ਪ੍ਰੋਡਕਟ ਆ ਸਾਡਾ ਉਹ ਤੇ ਉਹ ਭਾਅ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਐਡੀਡਸ ਦੇ ਵੀ ਕਾਫੀ ਮਾਡਲ ਅਵੇਲੇਬਲ ਹੈ ਜਿਵੇਂ ਅੱਜਕਲ ਅਲਟਰਾ ਬੂਸਟ ਤੁਸੀਂ ਦੇਖਿਆ ਹੋਣਾ ਹਾਂਜੀ ਉੱਦਾਂ ਵੀ ਭਾਅ ਜੀ ਇਦਾਂ ਕੈਜ਼ੁਅਲ ਵੇਅਰ 'ਚ ਵੀ ਪਈਆਂ ਤੇ ਉਹ ਬੂਟ ਹਾਂ ਭਾਈ ਤੁਹਾਨੂੰ ਕਿਹੜਾ ਚਾਹੀਦਾ ਨੌ ਨੰਬਰ ਹਾ ਹਾ ਭਾਜੀ ਮਿਲ ਜਾਣਾ ਲਗਭਗ ਸਾਰਿਆਂ 'ਚ ਨਵਾਂ ਆਇਆ ਸਟੋਕ ਸਾਰਾ ਹੁਣ ਪਿਆ ਹੀ ਹੈਗਾ ਹਾਂਜੀ ਹਾਂਜੀ ਤੇ ਹੋਰ ਭਾਅ ਜੀ ਇਹ ਦੋਨੋਂ ਹੀ ਮਾਡਲ ਹੈ ਤਾਂ ਵਧੀਆ ਹੈਗੇ ਵਧੀਆ ਜਾ ਹਾਂਜੀ ਹਾਂਜੀ ਭਾਅ ਜੀ ਦੋਨੋਂ ਹੀ ਨਾ ਪੂਰੇ ਲਾਈਟ ਵੇਟ ਹੈਗੇ ਤੇ ਬਸ ਉਹੀ ਹੈਗਾ ਹੈ ਐਡੀਜਸ ਆਲੇ ਹੈਗੇ ਭਾਅ ਜੀ ਉਹ ਨੋ ਹਜਾਰ ਦੇ ਆ ਤੇ ਪਿਉਮਾ ਵਾਲੇ ਥੋੜੇ ਹਜਾਰ ਖੰਡ ਸਸਤੇ ਆ ਬਾਕੀ ਚੀਜ਼ ਲਗਭਗ ਸੇਮ ਹੀ ਹ ਬ੍ਰਾਂਡ ਦਾ ਹੀ ਫਰਕ ਹੈਗਾ ਹਾਂਜੀ ਹਾਂਜੀ ਤੇ ਰਨਿੰਗ ਜਿਦਾ ਪੂਰਾ ਮਤਲਬ ਐਨ ਘੈਂਟ ਸ਼ਜ਼ ਆ ਸਾਡੇ ਸਭ ਤੋਂ ਜਿਆਦਾ ਇਹ ਵਿਕਦੇ ਭਾਅ ਜੀ ਦੋਨਾਂ ਹੀ ਮਾਡਲ ਵਿਕਦੇ ਆ ਬਾਕੀ ਭਾਅ ਜੀ ਕੋਈ ਨਹੀਂ ਕਰ ਦਾਂਗੇ ਹਨਾ ਮਾਣ ਤਾਣ ਪੂਰਾ ਕਰਾਂਗੇ ਦੱਸ ਦਿਓ ਰਮਨ ਭਾਅ ਜੀ ਨੇ ਸਾਨੂੰ ਭੇਜਿਆ ਹੈਗਾ ਕੋਈ ਦਿੱਕਤ ਨੀ ਭਾਅ ਜੀ ਉਦਾਂ ਤਾਂ ਸ਼ਾਮ ਨੂੰ ਕਰ ਦਿੰਦੇ ਸੀ ਸੱਤ ਅੱਠ ਵਜੇ ਬੰਦ ਬਾਕੀ ਤੁਸੀਂ ਲੇਟ ਹੋ ਗਏ ਤਾਂ ਮੈਨੂੰ ਫੋਨ ਮਾਰ ਕੇ ਆਜਿਓ ਜਦ ਮਰਜੀ ਹਨਾ ਚਲੋ ਠੀਕ ਹੈ ਭਾਅ ਜੀ ਠੀਕ ਹੈ ਓਕੇ